ਮੈਂ ਆਪਣੇ ਚੱਲ ਰਹੇ ਪ੍ਰਦਰਸ਼ਨ ਨੂੰ ਜਾਂਚਣ ਲਈ ਅਤੇ ਹੋਰ ਬਿਹਤਰ ਬਣਾਉਣ ਲਈ ਤਕਨੀਕ ਦੀ ਵਰਤੋਂ ਵਿੱਚ ਬਹੁਤਾ ਯਕੀਨ ਨਹੀਂ ਰੱਖਦਾ ਮੈਂ ਇਹਨਾਂ ਚੀਜ਼ਾਂ ਦੀ ਵਰਤੋਂ ਬਹੁਤ ਜ਼ਿਆਦਾ ਨਹੀਂ ਕਰਦਾ ਪਰ ਇੰਨੀ ਗੱਲ ਜ਼ਰੂਰ ਹੈ ਕਿ ਮੈਂ ਇਸ ਤਕਨੀਕ ਦੀ ਵਰਤੋਂ ਸਿਰਫ ਸਮਾਂ ਦੇਖਣ ਲਈ ਕਰਦਾ ਹਾਂ ਕਿ ਮੈਂ ਕਿੰਨੇ ਸਮੇਂ ਤੋਂ ਸਿਹਤਮੰਦ ਰਹਿਣ ਲਈ ਕਸਰਤ ਕਰ ਰਿਹਾ ਹਾਂ ਜਾਂ ਸੈਰ ਕਰ ਰਿਹਾ ਹਾਂ ਇਸ ਤੋਂ ਜ਼ਿਆਦਾ ਮੈਂ ਕਿਸੇ ਐਪ ਦੀ ਵਰਤੋਂ ਨਹੀਂ ਕਰਦਾ ਪਰ ਮੈਂ ਅਕਸਰ ਹੀ ਆਪਣੇ ਕਦਮਾਂ ਨੂੰ ਗਿਣਦੇ ਹੋਏ ਇੱਕ ਦੂਰੀ ਦਾ ਅੰਦਾਜ਼ਾ ਲਗਾਉਂਦਾ ਹਾਂ ਇਸ ਦੇ ਨਾਲ ਹੀ ਮੈਂ ਆਪਣਾ ਟੀਚਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੇਰੇ ਕਈ ਰੋਜ਼ਾਨਾ ਸਿਹਤ ਟੀਚੇ ਹਨ ਜਿਸ ਵਿੱਚ ਪੈਂਤੀ ਤੋਂ ਚਾਲੀ ਮਿੰਟ ਹਰ ਰੋਜ਼ ਸੈਰ ਕਰਨੀ ਪੰਦਰਾਂ ਤੋਂ ਵੀਹ ਮਿੰਟ ਤੱਕ ਦੀ ਕਸਰਤ ਕਰਨੀ ਵੀਹ ਤੋਂ ਪੱਚੀ ਮਿੰਟ ਤੱਕ ਯੋਗਾ ਕਰਨਾ ਸਵੇਰ ਦੇ ਸਮੇਂ ਜਲਦੀ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਚੰਗਾ ਅਤੇ ਸਿਹਤਮੰਦ ਭੋਜਨ ਕਰਨਾ ਬਜ਼ਾਰੂ ਚੀਜ਼ਾਂ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਇਹ ਸਾਰੇ ਮੇਰੇ ਰੋਜ਼ਾਨਾ ਸਿਹਤ ਟੀਚੇ ਹਨ ਇਹਨਾਂ ਟੀਚਿਆਂ ਦੀ ਪ੍ਰਾਪਤੀ ਲਈ ਮੈਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਉਤਸ਼ਾਹਿਤ ਕਰਦਾ ਹਾਂ ਉਹਨਾਂ ਨੂੰ ਪ੍ਰੇਰਿਤ ਕਰਦਾ ਹਾਂ ਤਾਂ ਜੋ ਉਹ ਬਾਜ਼ਾਰੂ ਚੀਜ਼ਾਂ ਜੋ ਸਾਡੀ ਸਿਹਤ ਨੂੰ ਖ਼ਰਾਬ ਕਰਦੀਆਂ ਹਨ ਉਹਨਾਂ ਦੀ ਵਰਤੋਂ ਨਾ ਕਰਨ ਸਗੋਂ ਘਰ ਬਣਾਈਆਂ ਹੋਈਆਂ ਸਾਫ਼ ਥਰੀਆਂ ਚੀਜ਼ਾਂ ਦੀ ਵਰਤੋਂ ਕਰਨ ਸੈਰ ਕਰਨ ਸਮੇਂ 'ਤੇ ਸੌਣਾ ਅਤੇ ਅੰਮ੍ਰਿਤ ਵੇਲੇ ਉੱਠਣਾ ਚੰਗੀ ਸਿਹਤ ਦਾ ਇਕ ਰਾਜ ਹੈ ਜੋ ਸਾਡਾ ਟੀਚਾ ਹੋਣਾ ਚਾਹੀਦਾ ਹੈ